ਹੈਲੋ ਹਾਂਜੀ ਸਤਿ ਸ੍ਰੀ ਅਕਾਲ ਮੈਮ ਹਾਂਜੀ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਮੈਮ ਹਾਂਜੀ ਹਾਂਜੀ ਹਾਂਜੀ ਮੈਮ ਦੱਸਦੀ ਹਾਂ ਵੈਸੇ ਵੀ ਇੱਕ ਗੁਆਂਢੀ ਨੂੰ ਦੂਸਰੇ ਗੁਆਂਢੀ ਦੀ ਮਦਦ ਵੈਸੇ ਵੀ ਕਰਨੀ ਚਾਹੀਦੀ ਹੈ ਹਾਂਜੀ ਮੈਮ ਪੰਜਾਬ ਬਹੁਤ ਵੱਡਾ ਸ਼ਹਿਰ ਹੈ ਇੱਥੇ ਹੋਰ ਵੀ ਬਹੁਤ ਵੱਡੇ ਵੱਡੇ ਬਹੁਤ ਵੱਡਾ ਰਾਜ ਹੈ ਇੱਥੇ ਹੋਰ ਵੀ ਵੱਡੇ ਵੱਡੇ ਸ਼ਹਿਰ ਹੈਗੇ ਆ ਜਿੱਦਾਂ ਅੰਮ੍ਰਿਤਸਰ ਜਲੰਧਰ ਲੁਧਿਆਣਾ ਇਹਨਾਂ ਦੀਆਂ ਹ ਖਾਸੀਅਤ ਵੀ ਬਹੁਤ ਹੈ ਅੰਮ੍ਰਿਤਸਰ ਜਿੱਦਾਂ ਕਿ ਗੁਰੂ ਪੀਰ ਦੀ ਦਾ ਸਥਾਨ ਹੈ ਉੱਥੇ ਗੋਲਡਨ ਟੈਂਪਲ ਹੈਗਾ ਬਹੁਤ ਦੇਖਣ ਵਾਲੀ ਜਗ੍ਹਾ ਮੈਮ ਜੇ ਜਲੰਧਰ ਦੀ ਗੱਲ ਕਰੀਏ ਤਾਂ ਉੱਥੇ ਖੇਡਣ ਵਾਲਾ ਸਮਾਨ ਉੱਥੇ ਹੀ ਬਣਦਾ ਬਹੁਤ ਵਧੀਆ ਹਾਜੀ ਹਾਂਜੀ ਹੋਰ ਕੁਛ ਮੈਮ ਹਾਂਜੀ ਮੈਮ ਠੀਕ ਹੈ ਜੀ ਮੈਮ ਧੰਨਵਾਦ